ਪੰਦਰਾਂ ਮਈ ਦੋ ਹਜ਼ਾਰ ਇੱਕ ਸੱਤ ਮਾਰਚ ਉੱਨੀ ਸੌ ਅਠਾਨਵੇਂ ਸਤਾਰਾਂ ਜੂਨ ਉੱਨੀ ਸੌ ਨੜਿੱਨਵੇਂ ਪੱਚੀ ਜਨਵਰੀ ਦੋ ਹਜ਼ਾਰ ਦੋ ਗਿਆਰਾਂ ਜੁਲਾਈ ਉੱਨੀ ਸੌ ਪਚਾਨਵੇਂ